ਅਠਾਰਾਂ ਬਾਰਾਂ ਦੋ ਹਜ਼ਾਰ ਚੌਵੀ ਤੇਰਾਂ ਤਿੰਨ ਦੋ ਹਜ਼ਾਰ ਚੌਵੀ ਪੰਦਰਾਂ ਪੰਜ ਦੋ ਹਜ਼ਾਰ ਪੱਚੀ ਵੀਹ ਛੇ ਦੋ ਹਜ਼ਾਰ ਪੰਜ ਇੱਕ ਚਾਰ ਦੋ ਹਜ਼ਾਰ ਛੇ